ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਮਹੀਨਾ ਪਹਿਲਾਂ ਮੈਂ ਆਪਣੇ ਬੈਡ ਮੰਗਵਾਈ ਸੀ ਤੁਹਾਡੇ ਤੋਂ ਅਤੇ ਜੋ ਕਿ ਮੈਨੂੰ ਕਾਫੀ ਦੇਰ ਬਾਅਦ ਪੰਦਰਾਂ ਦਿਨਾਂ ਬਾਅਦ ਮਿਲੇ ਨੇ ਡਿਲੀਵਰੀ ਵਾਲਾ ਬੰਦਾ ਸੀ ਜਿਹੜਾ ਤੁਹਾਡਾ ਉਹ ਪਹਿਲਾਂ ਤਾਂ ਜਿੱਥੇ ਮੈਂ ਮੰਗਵਾਏ ਸੀਗੇ ਜਿਸ ਜਗ੍ਹਾ 'ਤੇ ਉੱਥੇ ਆਉਣ ਨੂੰ ਤਿਆਰ ਨਹੀਂ ਸੀਗਾ ਔਰ ਬੜੀ ਮੁਸ਼ਕਲ ਨਾਲ ਉਹਨੂੰ ਮਿੰਨਤਾਂ ਕਰਕੇ ਆਪਣੇ ਪੁਆਇੰਟ 'ਤੇ ਡੈਸੀਨੇਸ਼ਨ 'ਤੇ ਬੁਲਾਇਆ ਅਤੇ ਫਿਰ ਉਹ ਫਾਲਤੂ ਪੇਮੈਂਟ ਮੰਗ ਰਿਹਾ ਸੀ ਮੇਰੇ ਤੋਂ ਉੱਥੇ ਪਹੁੰਚਣ ਦੀ ਅਤੇ ਬੋਲਚਾਲ ਦਾ ਜਿਹੜਾ ਤਰੀਕਾ ਸੀ ਉਹਦਾ ਬਹੁਤ ਹੀ ਘਟੀਆ ਸੀ ਫਿਰ ਨਾ ਉਹਨੇ ਸਾਡੀ ਕੋਈ ਉਤਾਰਨ ਵਿੱਚ ਮਦਦ ਕੀਤੀ ਜਿਹੜੇ ਬੈਡ ਤੁਸੀਂ ਭੇਜੇ ਨੇ ਔਰ ਲੱਕੜ ਨੂੰ ਘੁਣ ਲੱਗਿਆ ਹੋਇਆ ਸੀਗਾ ਅਤੇ ਜਿਹੜੀ ਲੱਕੜ ਅਸੀਂ ਸ ਅ ਦੇ ਕਹੀ ਸੀ ਗੱਲ ਹੋਈ ਸੀ ਦੇਖੀ ਸੀ ਉਹ ਲੱਕੜ ਦੀ ਥਾਂ 'ਤੇ ਕੋਈ ਹੋਰ ਲੱਕੜ ਲਗਾਈ ਹੋਈ ਸੀ ਟਾਹਲੀ ਦੀ ਥਾਂ 'ਤੇ ਜਿਹੜੇ ਬੈਡ ਸੀਗੇ ਉਹ ਲੈਵਲ ਵਿੱਚ ਵੀ ਨਹੀਂ ਸਨ ਬੈਡਾਂ ਦੇ ਜਿਹੜੇ ਦਰਾਜ਼ ਸੀ ਉਹਨਾਂ ਦੇ ਹੈਂਡਲ ਬਹੁਤ ਹੀ ਘਟੀਆ ਸਨ ਜਦੋਂ ਅਸੀਂ ਖਿੱਚਣ ਲੱਗੇ ਤਾਂ ਉਹ ਹੱਥ 'ਚ ਹੀ ਆ ਗਏ ਟੁੱਟ ਗਏ ਸੀ ਰੇਟ ਵੀ ਤੁਹਾਡੇ ਸੀ ਜਿਹੜੇ ਉਹ ਬਾਜ਼ਾਰ ਨਾਲੋਂ ਕਾਫੀ ਵੱਧ ਸੀ ਗੱਦਿਆਂ ਦੀ ਜਿਹੜੀ ਕੁਆਲਿਟੀ ਵੀ ਕੋਈ ਜ਼ਿਆਦਾ ਵਧੀਆ ਨਹੀਂ ਸੀ ਜਿੱਥੇ ਅਸੀਂ ਬੈਠ ਕੇ ਦੇਖਿਆ ਜਾਂ ਪੈ ਕੇ ਦੇਖਿਆ ਉੱਥੇ ਹੀ ਬਸ ਉਸੇ ਸ਼ੇਪ 'ਚ ਹੀ ਰਹਿ ਜਾਂਦੇ ਸੀ ਆਪਣੀ ਦੁਬਾਰਾ ਸ਼ੇਪ ਜਿਹੜੀ ਉਹ ਰੀਗੇਨਡ ਨਹੀਂ ਸੀ ਕਰਦੇ ਹੁਣ ਜਾਂ ਤਾਂ ਮੇਰੇ ਪੈਸੇ ਤੁਸੀਂ ਵਾਪਸ ਕਰ ਦਿਉ ਜਾਂ ਫਿਰ ਜੋ ਮੈਂ ਅਸਲੀ ਚੀਜ਼ ਦੇਖੀ ਸੀ ਉਹੀ ਮੈਨੂੰ ਭੇਜ ਦਿਉ ਧੰਨਵਾਦ ਜੀ